ਅਸੀਂ ਇੱਕ ਦਿਨ ਨਾ ਆਨਲਾਈਨ ਦੇਖ ਰਹੇ ਸੀਗੇ ਸਮਾਨ ਉਹਦੇ ਵਿੱਚੋਂ ਸਾਨੂੰ ਬੈਡ ਸ਼ੀਟ ਵਧੀਆ ਲੱਗੀ ਅਸੀਂ ਸੋਚਿਆ ਕਿ ਬੈਡ ਸ਼ੀਟ ਮੰਗਾ ਲਈਏ ਕਦੇ ਮੰਗਾਇਆ ਤਾਂ ਹੈ ਨਹੀਂ ਸੀ ਕੁਛ ਪਹਿਲੀ ਵਾਰ ਔਨਲਾਈਨ ਸੈਂਡ ਕੀਤਾ ਸੀ ਸੋਚ ਲਿਆ ਕਿ ਮੰਗਾ ਲੈਂਦੇ ਹਾਂ ਚੱਲ ਵਧੀਆ ਲੱਗ ਹੋਈ ਤਾਂ ਹੋਰ ਮੰਗਾਲਾਂਗੇ ਅਸੀਂ ਇੱਕ ਔਨਲਾਈਨ ਬੈੱਡ ਸ਼ੀਟ ਮੰਗਾ ਲਈ ਅਤੇ ਉਹ ਜੇ ਪਹਿਲ ਖੋਲ੍ਹਦਿਆਂ ਨੂੰ ਪਹਿਲਾਂ ਤਾਂ ਐਈਂ ਲੱਗੀ ਗਿਆ ਵੀ ਮਨ ਨੂੰ ਪਤਾ ਨਹੀਂ ਕਿਸ ਤਰ੍ਹਾਂ ਦੀ ਹੋਊਗੀ ਪਤਾ ਨਹੀਂ ਫਸ ਹੀ ਨਾ ਜਾਈਏ ਖੋਲ੍ਹੀ ਤਾਂ ਖੋਲ੍ਹ ਕੇ ਸਾਨੂੰ ਵਧੀਆ ਲੱਗੀ ਵਿਛਾਈ ਵਧੀਆ ਲੱਗਿਆ ਰੰਗ ਕਲ ਵੀ ਵਧੀਆ ਲੱਗਿਆ ਪ੍ਰਿੰਟ ਵੀ ਵਧੀਆ ਲੱਗਿਆ ਵਿਛਾ ਕੇ ਥੋੜ੍ਹੇ ਚਿਰ ਬਾਅਦ ਹਫਤੇ ਕੁ ਬਾਅਦ ਜਦੋਂ ਅਸੀਂ ਧੋਤੀ ਤਾਂ ਕੋਈ ਰੰਗ ਨਹੀਂ ਨਿਕਲਿਆ ਕੋਈ ਕਲਰ ਫੇਟ ਨਹੀਂ ਹੋਇਆ ਕੁਛ ਨਹੀਂ ਹੋਇਆ ਵਧੀਆ ਨਿਕਲੀ ਸ਼ਰਿੰਕ ਵੀ ਨਹੀਂ ਹੋਈ ਕਾਟਨ ਦੀ ਚਾਦਰ ਡਬਲ ਬੈਡ ਸ਼ੀਟ ਵਧੀਆ ਨਿਕਲੀ ਆ ਕੋਈ ਕੰਪਲੀਟ ਨਹੀਂ ਨਿਕਲੀ ਅਤੇ ਧੋ ਧੂ ਕੇ ਵਧੀਆ ਨਿਕਲੀ ਨਿਕਲੀ ਪਹਿਲਾਂ ਤਾਂ ਡਰਦੇ ਰਹੇ ਔਨਲਾਈਨ ਅਸੀਂ ਵਧੀਆ ਪਹਿਲੀ ਵਾਰ ਮੰਗਾਈ ਸੀਗੀ ਪਰ ਜਿਵੇਂ ਕਿ ਪਹਿਲੀ ਵਾਰ ਮੰਗਾਈ ਸੀ ਬੁੱਕ ਕੀਤੀ ਸੀ ਵਧੀਆ ਨਿਕਲੀ ਥੈਂਕ ਯੂ